ਮੇਰੇ ਇਲਾਕੇ ਵਿਚ ਰਾਸ਼ਟਰੀ ਸਮਾਗਮਾਂ ਦਾ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਥਾਨਕ ਸਮਾਗਮ ਬਹੁਤ ਸਾਰੇ ਹੁੰਦੇ ਹਨ ਜਿਵੇਂ ਕਿ ਇਹਨਾਂ ਵਿੱਚੋਂ ਇੱਕ ਪਿੰਡ ਸੀਲ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਜਿੱਥੇ ਕਬੱਡੀ ਕੁਸ਼ਤੀ ਤੇ ਭਲਵਾਨੀ ਦੇ ਮੁਕਾਬਲੇ ਕਰਾਏ ਜਾਂਦੇ ਹਨ ਇਹਨਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਪਹੁੰਚਦੇ ਹਨ ਅਤੇ ਕਈ ਵਾਰੀ ਗਿਣਤੀ ਹਜ਼ਾਰਾਂ ਲੱਖਾਂ 'ਚ ਵੀ ਪਹੁੰਚ ਜਾਂਦੀ ਹੈ ਕਈ ਪਿੰਡ ਆਪਸ ਦੇ ਵਿੱਚ ਹੀ ਕ੍ਰਿਕਟ ਦੇ ਮੈਚ ਲਗਾਉਂਦੇ ਹਨ ਛੋਟੇ ਛੋਟੇ ਸਮਾਗਮ ਹੁੰਦੇ ਰਹਿੰਦੇ ਹਨ ਇਹਨਾਂ 'ਤੇ ਕਈ ਵਾਰ ਐੱਮ ਐੱਲ ਏ ਜਾਂ ਵੱਡੇ ਵੱਡੇ ਮੰਤਰੀਆਂ ਨੂੰ ਵੀ ਬੁਲਾਇਆ ਜਾਂਦਾ ਹੈ ਇਹ ਸਮਾਗਮਾਂ ਨੂੰ ਦੇਖਣ ਲਈ ਸਾਡੇ ਇਲਾਕੇ ਦੇ ਪਟਿਆਲੇ ਜ਼ਿਲ੍ਹੇ ਦੇ ਲੋਕ ਹੁੰਮ ਹੁੰਮਾ ਕੇ ਪਹੁੰਚਦੇ ਹਨ ਅਤੇ ਇੱਥੋਂ ਦਾ ਆਨੰਦ ਲੈਂਦੇ ਹਨ ਇੱਥੇ ਹੋਰ ਵੀ ਤਰ੍ਹਾਂ ਦੇ ਕਈ ਸਮਾਗਮ ਲਗਾਏ ਜਾਂਦੇ ਹਨ